ਹਾਂਜੀ ਮੈਂ ਕਰਮਵਾਲ ਕੌਰ ਅਸੀਂ ਊਬਰ ਊਬਰ ਤੋਂ ਆਪਣੀ ਕੈਬ ਬੁੱਕ ਕੀਤੀ ਸੀ ਕਿਉਂਕਿ ਮੇਰਾ ਅਗਜ਼ਾਮ ਸੀ ਤਾਂ ਮੈਨੂੰ ਸੀ ਕਿ ਮੈਂ ਆਪਣੇ ਅਗਜ਼ਾਮ ਸਥਾਨ 'ਤੇ ਟਾਈਮ ਨਾਲ ਪਹੁੰਚ ਸਕਾਂ ਇਸ ਲਈ ਮੈਂ ਜੋ ਹੈ ਔਨਲਾਈਨ ਕੈਬ ਔਡਰ ਕੀਤੀ ਪਰ ਟਾਈਮ ਜ਼ਿਆਦਾ ਲੱਗਣ ਕਰਕੇ ਮੈਨੂੰ ਹੋਰ ਕੈਬ ਜਿਹੜੀ ਉਹ ਬੁੱਕ ਕਰਨੀ ਪਈ ਜਦ ਕਿ ਮੈਂ ਪਹਿਲਾਂ ਵਾਲੀ ਕੈਬ ਦੀ ਆਪਣੀ ਜੋ ਪੇਮੈਂਟ ਆ ਉਹ ਵੀ ਔਨਲਾਈਨ ਕਰ ਦਿੱਤੀ ਸੀ ਤਾਂ ਮੈਨੂੰ ਸੀ ਕਿ ਮੈਂ ਟੈਮ ਨਾਲ ਪਹੁੰਚ ਸਕਾਂ ਬਟ ਟਾਈਮ ਜ਼ਿਆਦਾ ਲੱਗਣ ਕਰਕੇ ਉਹ ਟਾਈਮ ਨਾਲ ਨਹੀਂ ਪਹੁੰਚ ਸਕੀ ਇਸ ਲਈ ਮੈਨੂੰ ਹੋਰ ਕੈਬ ਜੋ ਹੈ ਬੁੱਕ ਕਰਨੀ ਪਈ ਤਾਂ ਮੈਨੂੰ ਇਹ ਮੈਂ ਜੋ ਮਤਲਬ ਕੈਬ ਕੈਬ ਊਬਰ ਦੇ ਜੋ ਵੀ ਡਰਾਈਵਰ ਹਨ ਮੈਂ ਉਹਨਾਂ ਨੂੰ ਇਹ ਸੁਝਾਅ ਦੇਣਾ ਚਾਹੁੰਦੀ ਹਾਂ ਕਿ ਉਹਨਾਂ ਨੂੰ ਆਪਣੇ ਨਿਸ਼ਚੇ ਟੈਮ 'ਤੇ ਪਹੁੰਚ ਜਾਣਾ ਚਾਹੀਦਾ ਕਿਉਂਕਿ ਕਈ ਵਾਰ ਅਸੀਂ ਟਾਈਮ ਜ਼ਿਆਦਾ ਲੱਗਣ ਕਰਕੇ ਆਪਣੇ ਜੋ ਮਹੱਤਵਪੂਰਨ ਕੰਮ ਹੈ ਉਹ ਕਰਨ ਤੋਂ ਲੇਟ ਹੋ ਜਾਂਦੇ ਹਾਂ ਤਾਂ ਸਾਨੂੰ ਹੋਰ ਵੀ ਬਹੁਤ ਸਾਰੀਆਂ ਪ੍ਰੋਬਲਮਾਂ ਦਾ ਸਾਹਮਣਾ ਕਰਨਾ ਪੈਂਦਾ ਤਾਂ ਮੇਰਾ ਇਹ ਸੁਝਾਅ ਹੈ ਊਬਰ ਅਤੇ ਕੈਬ ਦੇ ਡਰਾਈਵਰਾਂ ਨੂੰ ਕਿ ਟਾਈਮ ਨਾਲ ਪਹੁੰਚ ਪਹੁੰਚ ਸਕਣ ਅਤੇ ਤਾਂ ਕਿ ਜੋ ਅਸੀਂ ਅਪਣੇ ਕੰਮ ਹੈ ਉਹ ਟਾਈਮ ਨਾਲ ਸਮੇਂ ਸਿਰ 'ਤੇ ਨਿਬੇੜ ਸਕੀਏ